ਹਾਂਜੀ ਪੁਰਾਣੇ ਸਮੇਂ ਵਿੱਚ ਭੰਗੜਾ ਲੋਕੀ ਕਰ ਕਰਦੇ ਸੀ ਮਿਲ ਕੇ ਕਰਦੇ ਹੁੰਦੇ ਸੀ ਭੰਗੜਾ ਮੁੰਡਿਆਂ ਦਾ ਹੁੰਦਾ ਸੀ ਪਰ ਅੱਜ ਕੱਲ੍ਹ ਜਿਹੜਾ ਭੰਗੜਾ ਐਰੋਬਿਕਸ ਚੱਲਿਆ ਹੈ ਇਹ ਡਾਂਸ ਅਧਾਰਿਤ ਵਰਗਆਉਟ ਹੈ ਇਹ ਅੱਜ ਕੱਲ੍ਹ ਬੱਚੇ ਜਿੰਮ 'ਚ ਕਰਦੇ ਨੇ ਇਹਨੂੰ ਇੱਕ ਕਸਰਤ ਦੇ ਰੂਪ ਵਿੱਚ ਵੀ ਕੀਤਾ ਜਾਂਦਾ ਹੈ ਅਤੇ ਜਿਹਦੇ ਨਾਲ ਆਪਣਾ ਸਰੀਰ ਤੰਦਰੁਸਤ ਰਹਿੰਦਾ ਹੈ ਧੰਨਵਾਦ